ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਟਿਆਲੇ ਤੋਂ ਚੰਡੀਗੜ੍ਹ ਕਿਸੇ ਮੀਟਿੰਗ ਦੇ ਲਈ ਤੁਹਾਡੀ ਕੈਬ ਏਜੰਸੀ ਤੋਂ ਕੈਬ ਬੁੱਕ ਕੀਤਾ ਸੀਗਾ ਅਤੇ ਉਹਦੇ ਲਈ ਤੁਹਾਡੀਆਂ ਜਿਹੜੀਆਂ ਸ਼ਰਤਾਂ ਕੰਡੀਸ਼ਨਜ ਨੇ ਉਹਦੇ ਮੁਤਾਬਿਕ ਮੈਂ ਪੰਜਾਹ ਪਰਸੈਂਟ ਜਿਹੜੀ ਹੈਗੀ ਆ ਉਹ ਟਰੈਵਲ ਅਲਾਊਂਸ ਸੀਗੇ ਜਿਹੜੇ ਮੇਰੀ ਜਿਹੜੀ ਭੁਗਤਾਨ ਬਣਦਾ ਸੀਗਾ ਸਫਰ ਦਾ ਉਹ ਅੱਧਾ ਮੈਂ ਪਹਿਲਾਂ ਪੇ ਕਰਤਾ ਸੀਗਾ ਪਰ ਕਿਸੇ ਕਾਰਨ ਕਰਕੇ ਜਿਹੜੀ ਮੇਰੀ ਮੀਟਿੰਗ ਆ ਚੰਡੀਗੜ੍ਹ ਵਾਲੀ ਉਹ ਰੱਦ ਹੋ ਗਈ ਆ ਸੋ ਮੇਰਾ ਚੰਡੀਗੜ੍ਹ ਮੀਟਿੰਗ ਲਈ ਜਾਣ ਦਾ ਹੁਣ ਕੋਈ ਮਤਲਬ ਜਿਹੜਾ ਉਹਦੀ ਵਜ੍ਹਾ ਨਹੀਂ ਬਣਦੀ ਕੋਈ ਐਕਸਕਿਊਜ਼ ਨਹੀਂ ਬਣਦਾ ਰੀਜ਼ਨ ਨਹੀਂ ਬਣਦਾ ਸੋ ਮੈਨੂੰ ਆਪਣਾ ਜਿਹੜੀ ਹੈਗੀ ਆ ਉਹ ਮੀਟਿੰਗ ਦੇ ਰੱਦ ਹੋਣ ਕਰਕੇ ਆਪਣਾ ਸਫਰ ਜਿਹੜਾ ਆਪਣਾ ਟਰੈਵਲ ਰੱਦ ਕਰਨਾ ਪੈ ਰਿਹਾ ਅਤੇ ਮੈਂ ਜਿਹੜੀ ਪੰਜਾਹ ਪਰਸੈਂਟ ਜਿਹੜੀ ਤੁਹਾਨੂੰ ਅਦਾਇਗੀ ਦਿੱਤੀ ਹੈ ਸਫਰ ਦੀ ਪਹਿਲਾਂ ਅਤੇ ਉਹ ਮੈਂ ਚਾਹੁੰਦਾ ਕਿ ਮੈਨੂੰ ਜਲਦੀ ਤੋਂ ਜਲਦੀ ਜਿਹੜੀ ਹੈਗੀ ਆ ਉਹ ਮੇਰੇ ਖਾਤੇ ਦੇ ਵਿੱਚ ਵਾਪਸ ਕੀਤੀ ਜਾਵੇ ਥੈਂਕ ਯੂ